ਟੈਕਨੋਲਜੀ ਨੇ ਸਾਰੀ ਏ ਸਾਰਿਆਂ ਦੀ ਜ਼ਿੰਦਗੀ ਵਿੱਚ ਪ੍ਰਭਾਵ ਪਾਇਆ ਹੈ ਟੈਕਨੋਲਜੀ ਨਾਲ ਬਹੁਤ ਚੀਜ਼ਾਂ ਆਸਾਨ ਹੋ ਗਈਆਂ ਨੇ ਜਿਵੇਂ ਬੈਂਕਿੰਗ ਲਾ ਲੈਂਦੇ ਆ ਆਪਾਂ ਬੈਂਕਿੰਗ ਦੇ ਵਿੱਚ ਜਿਵੇਂ ਪਹਿਲਾਂ ਬੰਦੇ ਨੂੰ ਸਪੈਸ਼ਲ ਛੁੱਟੀ ਕਰਨੀ ਪੈਂਦੀ ਸੀਗੀ ਛੁੱਟੀ ਕਰਨ ਕੇ ਫਿਰ ਬੈਂਕ ਜਾਣਾ ਪੈਂਦਾ ਸੀਗਾ ਬੈਂਕ 'ਚ ਲੰਬੀਆਂ ਲਾਈਨਾਂ ਦੇ ਵਿੱਚ ਖੜ੍ਹ ਕੇ ਫਿਰ ਉਸਨੂੰ ਪੈਸੇ ਕਢਵਾਉਂਦਾ ਸੀਗਾ ਅਤੇ ਫਿਰ ਦੂਸਰੇ ਬੰਦੇ ਨੂੰ ਜਿਸ ਨੂੰ ਦੇਣੇ ਸੀਗੇ ਉਹਨੂੰ ਦੇਣ ਸੀਗਾ ਟੈਕਨੋਲਜੀ ਆ ਗਈ ਤਾਂ ਆਪਾਂ ਕੰਮ ਦੇ ਦਸ ਮਿੰਟ ਵੀ ਕੱਢ ਕੇ ਇੱਕ ਦਸ ਮਿੰਟ ਦੇ ਵਿੱਚ ਆਪਾਂ ਦੂਸਰੇ ਨੂੰ ਪੈਰੇ ਟਰਾਂਸਫਰ ਕਰ ਦਿੰਦੇ ਹਾਂ ਸਭ ਤੋਂ ਬੜਾ ਫਾਇਦਾ ਤਾਂ ਇਹ ਆ ਦੂਸਰਾ ਆਪਾਂ ਨੂੰ ਕੋਈ ਵੀ ਚੀਜ਼ ਆ ਚਾਹੇ ਉਹ ਘਰ ਦਾ ਸਮਾਨ ਏ ਹੈ ਉਹ ਆਪਾਂ ਘਰ ਬੈਠੇ ਹੀ ਔਡਰ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਉਹ ਅੱਧੇ ਘੰਟੇ 'ਚ ਵੀਹ ਮਿੰਟ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਆਪਾਂ ਨੂੰ ਕੋਈ ਸਪੈਸ਼ਲ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਹੋਟਲ ਬੁਕਿੰਗ ਹੋ ਜਾਂਦੀਆਂ ਨੇ